ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਅਸੀਂ ਗ੍ਰੇ ਮੈਟਰਸ ਤੋਂ ਹੀ ਬੋਲਦੇ ਹਾਂ ਜੀ ਤੁਹਾਨੂੰ ਕਿਸ ਬਾਰੇ ਜਾਣਕਾਰੀ ਚਾਹੀਦੀ ਸੀ ਤੁਸੀਂ ਪੜ੍ਹਾਈ ਕਿੰਨੀ ਕੀਤੀ ਹੋਈ ਹੈ ਗ੍ਰੈਜੂਏਸ਼ਨ ਕੀਤੀ ਹੋਈ ਜਾਂ ਫੇਰ ਪਲੱਸ ਟੂ ਕੀਤੀ ਹੋਈ ਹੈ ਜੀ ਅੱਛਾ ਜੀ ਤੁਸੀਂ ਕਿਹੜੇ ਸਟਰੀਮ ਦੇ ਵਿੱਚ ਪਲੱਸ ਟੂ ਕੀਤੀ ਹੈ ਜੀ ਅੱਛਾ ਅੱਛਾ ਅੱਛਾ ਜੀ ਅਤੇ ਤੁਹਾਡੇ ਕਿੰਨੇ ਪਰਸੈਂਟ ਨੰਬਰ ਸੀ ਜੀ ਠੀਕ ਹੈ ਜੀ ਤੁਸੀਂ ਆਈ ਉਥ ਕਨੇਡਾ ਵਾਸਤੇ ਤੁਹਾਨੂੰ ਸਾਢੇ ਛੇ ਬੈਂਡਾਂ ਦੀ ਜ਼ਰੂਰਤ ਹੈਗੀ ਹੈ ਜੀ ਆਈਲੈਟਸ 'ਚ ਲੈਣੇ ਪੈਣੇ ਹੈ ਬਾਕੀ ਤੁਸੀਂ ਸਾਡੇ ਔਫਿਸ ਆ ਕੇ ਵਿਜ਼ਿਟ ਕਰ ਲਓ ਇੱਕ ਵਾਰੀ ਜਿਸ ਤਰ੍ਹਾਂ ਵੀ ਹੋਇਆ ਅਸੀਂ ਤੁਹਾਨੂੰ ਸਾਰਾ ਪੇਪਰ 'ਤੇ ਸਮਝਾ ਦੇਵਾਂਗੇ ਜੀ ਠੀਕ ਹੈ ਜੀ ਸਾਡਾ ਔਫਿਸ ਸਵੇਰੇ ਦਸ ਵਜੇ ਖੁੱਲਦਾ ਜੀ ਹਾਂਜੀ ਤੁਸੀਂ ਦਸ ਵਜੇ ਤੋਂ ਲੈ ਕੇ ਸ਼ਾਮੀ ਚਾਰ ਵਜੇ ਤੱਕ ਜਦੋਂ ਮਰਜ਼ੀ ਆ ਸਕਦੇ ਹੋ ਠੀਕ ਹੈ ਜੀ